ਬਾਗਬਾਨੀ ਸਾਡੇ ਬਜ਼ੁਰਗਾਂ ਤੋਂ ਚੱਲ ਚੱਲਦੀ ਆ ਰਹੀ ਹੈ ਅਤੇ ਮੈਂ ਵੀ ਬਾਗਬਾਨੀ ਸ਼ੁਰੂ ਤੋਂ ਛੋਟਾ ਹੁੰਦਾ ਹੀ ਕਰਦਾ ਆ ਰਿਹਾ ਅਤੇ ਅਤੇ ਸੰਤਰੇ ਦੇ ਬੂਟੇ ਅਤੇ ਅਮਰੂਦ ਦੇ ਬੂਟੇ ਸਾਰੇ ਤਰ੍ਹਾਂ ਦੇ ਬੂਟੇ ਮੈਂ ਲਗਾ ਲਗਾ ਖੇਤ ਵਿੱਚ ਲਗਾਏ ਹੋਏ ਹਨ ਅਤੇ ਸਬਜ਼ੀਆਂ ਵੀ ਸਾਰੀਆਂ ਮੈਂ ਆਪ ਪੈਦਾ ਕਰਦਾ ਹਾਂ ਅਤੇ ਜਿਹਨੇ ਦੇਸੀ ਰੇਹ ਪਾ ਕੇ ਤਿਆਰ ਕਰਦਾ ਹਾਂ ਬਾਹਰ ਦੀ ਸਬਜ਼ੀ ਦਾ ਕੋਈ ਪਤਾ ਨਹੀਂ ਕਿੰਨਾ ਕੈਮੀਕਲ ਉਸ ਮੈਂ ਪਾਇਆ ਕਿੰਨੀ ਕੁ ਉਹਦੀ ਬਿਮਾਰੀ ਲੱਗਣੀ ਹੈ ਖਾਣ 'ਤੇ ਅਸੀਂ ਸਾਰੀਆਂ ਸਬਜ਼ੀਆਂ ਆਪ ਘਰੇ ਤਿਆਰ ਕਰਕੇ ਖਾਂਦੇ ਆ ਅਤੇ ਫਰੂਟ ਵੀ ਸਾਰੇ ਆਪਣੇ ਘਰ ਵਿੱਚ ਖੇਤਾਂ ਵਿੱਚ ਲਾਏ ਹੋਏ ਹਨ ਅਤੇ ਉਹੀ ਅਸੀਂ ਖਾਂਦੇ ਹਾਂ ਬਾਹਰ ਤੋਂ ਚੀਜ਼ ਬਹੁਤ ਘੱਟ ਖਰੀਦਦੇ ਹਨ